ਸਾਡਾ ਧਰਮ ਸਾਨੂੰ ਸਿਹਤ ਦੀ ਸੰਭਾਲ ਬਾਰੇ ਸਿਖਾਉਂਦਾ ਆ ਜਿਵੇਂ ਕਿ ਸਾਦਾ ਖਾਣਾ ਖਾਣਾ ਚਾਹੀਦਾ ਆ ਅਤੇ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਆਪਾਂ ਗੁੱਸਾ ਕਰਾਂਗੇ ਤਾਂ ਮਾਨਸਿਕ ਤਨਾਅ ਆਵੇਗਾ ਲੜਾਈ ਝਗੜਾ ਨਹੀਂ ਕਰਨਾ ਅਤੇ ਨਿੰਦਾ ਚੁਗਲੀ ਨਹੀਂ ਕਰਨੀ ਸੱਚ ਬੋਲਣਾ ਸਿਖਾਉਂਦਾ ਹੈ ਸਾਡਾ ਧਰਮ ਸਾਨੂੰ ਵੈਰ ਵਿਰੋਧ ਕਰਨਾ ਨਹੀਂ ਸਿਖਾਉਂਦਾ ਸਾਡਾ ਧਰਮ ਸਾਨੂੰ ਇਹ ਕਹਿੰਦਾ ਹੈ ਕਿ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਤੁਸੀਂ ਕਿਸੇ ਦੀ ਨਿੰਦਾ ਨਹੀਂ ਕਰਨੀ ਬਹੁਤ ਵਧੀਆ ਵਧੀਆ ਗੱਲਾਂ ਸਿਖਾਉਂਦਾ ਸਾਡਾ ਧਰਮ ਸਾਨੂੰ ਜਿਵੇਂ ਕਿ ਸੇ